ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਂ ਅਰੁਣਾ ਸਾਡੇ ਪੰਜਾਬ ਦੇ ਵਿੱਚ ਸਾਰਾ ਹੀ ਹੈਗਾ ਵਾ ਕਿਸਾਨਾਂ ਦਾ ਕਿੰਨਾ ਨਹੀਂ ਇੱਥੇ ਮੇਲੇ ਲੱਗਦੇ ਆ ਮੇਲੇ ਲੱਗਦੇ ਆ ਇੱਥੇ ਸਾਰਾ ਕੁਛ ਕਿੰਨਾ ਨਹੀਂ ਹੁੰਦਾ ਸਰਕਾਰ ਵੱਲੋਂ ਉਹ ਦੱਸਦੇ ਆ ਤਕਨੀਕ ਤਾਂ ਵੀ ਜਿਹੜੀਆਂ ਫਸਲਾਂ ਕਿੱਦਾਂ ਉਗਾਉਂਦੇ ਆ ਲਾਉਂਦੇ ਆ ਉਹ ਦੱਸਦੇ ਹੈ ਸਾਨੂੰ ਕਿੰਨਾ ਨਹੀਂ ਵੀ ਇੱਦਾਂ ਇੱਦਾਂ ਕਰੋ ਤੁਸੀਂ ਇੱਦਾਂ ਫਸਲਾਂ ਲਾਓ ਤੁਸੀਂ ਉਹ ਹਥਿਆਰ ਵੀ ਦੱਸਦੇ ਹੈ ਹਥਿਆਰ ਦਿੰਦੇ ਆ ਕਈ ਕਈ ਹਲ ਵਗੈਰਾ ਵਗੈਰਾ ਇੱਦਾਂ ਦੀਆਂ ਚੀਜ਼ਾਂ ਕਈ ਤਰ੍ਹਾਂ ਦੀਆਂ ਦਿੰਦੇ ਹੈ ਉਹ ਕਹਿੰਦੇ ਵੀ ਤੁਸੀਂ ਨਾ ਕਿੰਨਾ ਨਹੀਂ ਇਹ ਵਾਲੇ ਬੀਜ ਵਰਤੋ ਇਹ ਮਤਲਬ ਦੱਸਦੇ ਹੈ ਸਾਨੂੰ ਉਹ ਲਾਉਂਦੇ ਹੈ ਸਰਕਾਰ ਵੱਲੋਂ ਵੀ ਉਹ ਕੈਂਪ ਜਿਹੇ ਲਾਉਂਦੇ ਆ ਦੱਸਦੇ ਹੈ ਵੀ ਇਹ ਲਾਓ ਚੀਜ਼ਾਂ ਬੂਟੇ ਦਿੰਦੇ ਆ ਅਤੇ ਉਹਦੇ ਵਿੱਚ ਕਿੰਨਾ ਨਹੀਂ ਸਾਰਾ ਕੁਛ ਫੁੱਲਾਂ ਦੇ ਫੁੱਲਾਂ ਦੇ ਸਾਰਾ ਕੁਝ ਦਿੰਦੇ ਹੈ ਫੁੱਲ ਵਗੈਰਾ ਸਾਰੀਆਂ ਫਸਲਾਂ ਫਰੂਟ ਸਾਰਾ ਕਿੰਨਾ ਨਹੀਂ ਫਰੂਟਾਂ ਦਾ ਕਿੰਨਾ ਨਹੀਂ ਕਰਦੇ ਹੈ ਵੀ ਇੱਦਾਂ ਇੱਦਾਂ ਲਾਓ ਇੱਦਾਂ ਇੱਦਾਂ ਮਤਲਬ ਵੀ ਤੁਸੀਂ ਬੀਜੋ ਅਤੇ ਇਹ ਵਾ ਵੀ ਸਾਡਾ ਬਹੁਤ ਕਿੰਨਾ ਨਹੀਂ ਠੀਕ ਆ ਅਤੇ ਸਾਨੂੰ ਕਿੰਨਾ ਨਹੀਂ ਬਹੁਤ ਕਿੰਨਾ ਨਹੀਂ ਕਿਸਾਨ ਮਦਦ ਵੀ ਕਰਦੇ ਹੈ ਕਰਜ਼ਾ ਵੀ ਦਿੰਦੀ ਹੈ ਮਦਦ ਕਰਦੇ ਹੈ ਕਰਜ਼ਾ ਦਿੰਦੀ ਹੈ ਫਸਲਾਂ ਵਾਸਤੇ ਫਸਲਾਂ ਵਾਸਤੇ ਫਰੂਟ ਵਾਸਤੇ ਦਿੰਦੇ ਆ ਵੀ ਤੁਸੀਂ ਇਹ ਫਰੂਟ ਵਾਸਤੇ ਪੈਸੇ ਤੁਸੀਂ ਲਓ ਸਾਨੂੰ ਥੋੜ੍ਹੇ ਥੋੜ੍ਹੇ ਕਰਕੇ ਦਿਓ ਇਹ ਹਥਿਆਰ ਲਿਓ ਹਥਿਆਰ ਵੀ ਦਿੰਦੇ ਹੈ ਵੀ ਕਹੀ ਹੋ ਗਈ ਇੱਕ ਉਹ ਦਿੰਦੇ ਹੈ ਹਲ ਵਗੈਰਾ ਫਿਰ ਅੱਗੇ ਕਿੰਨਾ ਨਹੀਂ ਹੋਰ ਰੂੜੀ ਰਾੜੀ ਜੋ ਵੀ ਪਾਉਣੀ ਹੈ ਖਾਦਾਂ ਖੁੱਦਾਂ ਵਾਸਤੇ ਸਾਰਾ ਦਿੰਦੇ ਹੈ ਉਹ ਕਰਜ਼ਾ ਦਿੰਦੇ ਹੈ ਉਹ ਕਹਿੰਦੇ ਤੁਸੀਂ ਹੌਲੀ ਹੌਲੀ ਸਾਨੂੰ ਵਾਪਸ ਕਰ ਦਿਓ ਅਤੇ ਤੁਸੀਂ ਸਾਡੇ ਕੋਲ ਪੈਸੇ ਲੈ ਕੇ ਵਧੀਆ ਤਰ੍ਹਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿੱਦਾਂ ਪਹਿਲਾਂ ਦਿੰਦੇ ਸੀ ਨਾ ਅਤੇ ਪਹਿਲਾਂ ਉਹ ਸਮਾਨ ਨਹੀਂ ਸੀ ਵਰਤ ਹੁੰਦਾ ਹੁਣ ਉਹ ਵਧੀਆ ਸਮਾਨ ਹੁਣ ਦੇ ਅੱਜ ਕੱਲ੍ਹ ਦੇ ਜ਼ਮਾਨੇ ਦਾ ਦਿੰਦੇ ਵੀ ਤੁਹੀਂ ਇਹਦੇ ਨਾਲ ਕਟਾਈ ਵਢਾਈ ਇੱਦਾਂ ਬੀਜ ਇੱਦਾਂ ਲਾਓ ਤੁਸੀਂ ਕਿੰਨਾ ਨਹੀਂ ਕਰੋ ਤੁਸੀਂ ਕਿੱਦਾਂ ਇੱਦਾਂ ਤੁਹਾਡੇ ਉਹ ਕੰਮ ਬਹੁਤ ਵਧੀਆ ਚੰਗੀਆਂ ਸਬਜ਼ੀਆਂ ਫਲ ਚੰਗਾ ਪਏਗਾ ਸਾਰਾ ਕੁਛ ਚੰਗਾ ਹੋਏਗਾ ਮੈਨੂੰ ਜਿੰਨਾ ਕੁ ਪਤਾ